ਵਿਗਿਆਨ ਅਤੇ ਤਕਨਾਲੋਜੀ ਬਾਰੇ ਸਾਨੂੰ ਬਹੁਤ ਚੀਜ਼ਾਂ ਆਕਰਸ਼ਿਤ ਮਿਲਦੀਆਂ ਹਨ ਜਿ ਜਿਵੇਂ ਵੀ ਸਾਨੂੰ ਕੋਈ ਵੀ ਚੀਜ਼ ਦੀ ਲੋੜ ਹੁੰਦੀ ਹੈ ਵਿਗਿਆਨ ਬਾਰੇ ਅਸੀਂ ਗੂਗਲ ਤੋਂ ਜਦੇ ਹੀ ਪ੍ਰਾਪਤ ਕਰ ਲੈਂਦੇ ਹਾਂ ਇਸ ਲਈ ਸਾਨੂੰ ਇਹ ਟੈਕਨਾਲੋਜੀ ਤੋਂ ਬਹੁਤ ਸਾਰੇ ਆਕਰਸ਼ਿਤ ਪੈਦਾ